ਸਤਿ ਸ਼੍ਰੀ ਅਕਾਲ ਜੀ ਮੈਂ ਵੀ ਪ੍ਰੋੋਫੈਸ਼ਨਲ ਚਿੱਤਰਕਾਰ ਤਾਂ ਨਹੀਂ ਹਾਂ ਪਰ ਹਾਂ ਜਿਵੇਂ ਜਦੋਂ ਚਿੱਤਰਕਾਰੀ ਦੇ ਵਿੱਚ ਮੇਰੀ ਰੁਚੀ ਬਹੁਤ ਹੈ ਹਾਂ ਅਤੇ ਜਦੋਂ ਅਸੀਂ ਚਿੱਤਰਕਾਰੀ ਸ਼ੁਰੂ ਕਰਦੇ ਹਾਂ ਨਾ ਤਾਂ ਸਾਨੂੰ ਉਹਦੀ ਬਰੀਕੀਆਂ ਦਾ ਪਤਾ ਨਹੀਂ ਹੁੰਦਾ ਅਸੀਂ ਇੱਕੋ ਹੀ ਪੈਂਸਲ ਦੇ ਨਾਲ ਹਰ ਤਰ੍ਹਾਂ ਦੀ ਡਰੋਇੰਗ ਕਰਨੀ ਸ਼ੁਰੂ ਕਰ ਦਿੰਦੇ ਹਾਂ ਅਸੀਂ ਹਰ ਤਰੀਕੇ ਦੀ ਚਿੱਤਰਕਾਰੀ ਕਰਨਾ ਸ਼ੁਰੂ ਕਰ ਦਿੰਦੇ ਹਾਂ ਹਾਂ ਜਦੋਂ ਅਸੀਂ ਰ ਰੰਗ ਲੈਣ ਵੀ ਬਾਜ਼ਾਰ ਦੇ ਵਿੱਚ ਜਾਂਦੇ ਹਾਂ ਨਾ ਸਾਨੂੰ ਇਹ ਨਹੀਂ ਪਤਾ ਹੁੰਦਾ ਸੀ ਕਿ ਮੈਨੂੰ ਇਹ ਨਹੀਂ ਸਮਝ ਆਉਂਦੀ ਹੁੰਦੀ ਸੀ ਕਿ ਤੁਸੀਂ ਬ੍ਰਸ਼ ਦੇ ਇੰਨੇ ਟਾਈਪ ਕਿਉਂ ਹੁੰਦੇ ਨੇ ਇੱਕੋ ਜਿਹੇ ਰੰਗ ਹੀ ਭਰਨੇ ਆਪਾਂ ਤਾਂ ਇੱਕ ਬ੍ਰਸ਼ ਨਾਲ ਭਰ ਲਈਏ ਲੇਕਿਨ ਜਿਵੇਂ ਜਿਵੇਂ ਸਾਨੂੰ ਚਿੱਤਰਕਾਰੀ ਦੀ ਨੌਲੇਜ ਵਧਦੀ ਜਾਂਦੀ ਹੈ ਤਾਂ ਸਾਨੂੰ ਸਮਝ ਆਉਂਦਾ ਹੈ ਕਿ ਹਰ ਬ੍ਰਸ਼ ਇੱਕ ਅਲੱਗ ਮਹੱਤਵ ਰੱਖਦਾ ਚਿੱਤਰਕਾਰੀ ਦੇ ਵਿੱਚ ਚਿੱਤਰ ਜੋ ਡਰੋਇੰਗ ਦਾ ਨਿਖਾਰ ਹੈ ਉਹ ਇੱਕ ਸਹੀ ਸੋਚ ਮਤਲਬ ਇਹ ਵੀ ਇੱਕ ਵਿਸ਼ੇ ਦੀ ਤਰ੍ਹਾਂ ਹੈ ਇਹਨੂੰ ਜਿੰਨਾ ਪੜ੍ਹਾਂਗੇ ਓਨੀ ਸਾਨੂੰ ਚਿੱਤਰਕਾਰੀ ਦੇ ਵਿੱਚ ਸਮਝ ਆਏਗੀ ਓਨੀ ਸਾਡੀ ਚਿੱਤਰਕਾਰੀ ਨਿਖਰ ਕੇ ਆਵੇਗੀ ਇੱਕ ਚੰਗੇ ਕਲਾਕਾਰ ਬਣਨ ਦੇ ਲਈ ਅਭਿਆਸ ਦੀ ਤਾਂ ਲੋੜ ਹੈ ਹੀ ਕਿਉਂਕਿ ਕੋਈ ਵੀ ਚੀਜ਼ ਆਸਾਨੀ ਦੇ ਨਾਲ ਨਹੀਂ ਮਿਲਦੀ ਹੁੰਦੀ ਸਮਾਂ ਪਾ ਕੇ ਅਭਿਆਸ ਕਰਕੇ ਹੀ ਤੁਸੀਂ ਉਸ ਦੇ ਵਿੱਚ ਪਰਫੈਕਟ ਹੋ ਸਕਦੇ ਹੋ ਹਾਂ ਜੋ ਕੁਝ ਬੱਚੇ ਹੁੰਦੇ ਨੇ ਕੁਝ ਕਲਾਕਾਰ ਇੱਦਾਂ ਦੇ ਹੁੰਦੇ ਨੇ ਕਿ ਹਾਂ ਜਿਹਨਾਂ ਨੂੰ ਰੱਬ ਦੀ ਦੇਣ ਹੁੰਦੀ ਹੈ ਅਤੇ ਉਹਨਾਂ ਦੇ ਵਿੱਚ ਉਹ ਸ਼ੁਰੂ ਤੋਂ ਹੀ ਇੱਕ ਉੱਭਰਦੇ ਹੋਏ ਚਿੱਤਰਕਾਰ ਹੁੰਦੇ ਹਨ ਚਿੱਤਰਕਾਰ ਹੁੰਦੇ ਹਨ ਪਰ ਜੇਕਰ ਅਸੀਂ ਜਿਵੇਂ ਮੇਰੀ ਗੱਲ ਕਰੀਏ ਤਾਂ ਜਿਹੜੇ ਆਪਣੇ ਪਸੰਦੀਦਾ ਪੇਸ਼ੇ ਵਜੋਂ ਇਸਨੂੰ ਸ਼ੁਰੂ ਕਰਦੇ ਹਨ ਤਾਂ ਉਹਨਾਂ ਨੂੰ ਇੱਕ ਪਰਫੈਕਟ ਚਿੱਤਰਕਾਰ ਬਣਨ ਦੇ ਵਿੱਚ ਟਾਈਮ ਤਾਂ ਜ਼ਰੂਰ ਲੱਗਦਾ ਹੈ ਧੰਨਵਾਦ